ਬਚਪਨ ਵਿੱਚ ਮੈਂ ਕਈ ਤਿਉਹਾਰਾਂ ਅਤੇ ਧਾਰਮਿਕ ਮੌਕਿਆਂ ਦੇ ਵਿੱਚ ਆਪਾਂ ਦੀਵਾਰਾਂ ਦੇ ਉੱਤੇ ਆਪਾਂ ਮੂਰਤੀਆਂ ਉਲੀਕਦੇ ਹੁੰਦੇ ਸਨ ਮੂਰਤੀਆਂ ਬਣਾਉਂਦੇ ਹੁੰਦੇ ਸਨ ਅਤੇ ਕਈ ਵਾਰ ਤਾਂ ਮੂਰਤੀਆਂ ਆਪਾਂ ਮਿੱਟੀ ਦੀਆਂ ਵੀ ਬਣਾਉਂਦੇ ਹੁੰਦੇ ਸਨ ਅਤੇ ਜਿੱਦਾਂ ਕਿ ਆਪਾਂ ਦਿਵਾਲੀ ਦੇ ਮੌਕੇ ਦੇ ਉੱਤੇ ਪਹਿਲੇ ਆਪਾਂ ਇੱਕ ਘਰ ਦੇ ਇੱਕ ਕੋਨੇ ਦੇ ਵਿੱਚ ਆਪਾਂ ਗੋਬਰ ਦੇ ਨਾਲ ਕੰਧ ਨੂੰ ਆਪਾਂ ਲੇਪਦੇ ਹੁੰਦੇ ਸੀ ਫਿਰ ਉਹਦੇ ਉੱਤੇ ਆਪਾਂ ਰੰਗ ਦੇ ਨਾਲ ਕੋਈ ਕੱਚੇ ਰੰਗ ਦੇ ਨਾਲ ਆਪਾਂ ਉਹ ਉਹਦੇ ਉੱਤੇ ਇੱਕ ਇੱਕ ਬੇਸ ਬਣਾਉਣ ਲਈ ਪਿੱਛੇ ਆਪਾਂ ਉਤ ਉਹ 'ਤੇ ਕੱਚਾ ਰੰਗ ਫੇਰਦੇ ਹੁੰਦੇ ਸਾਂ ਫਿਰ ਆਪਾਂ ਘਰ ਦੇ ਸਮਾਨ ਜਿੱਦਾਂ ਕਿ ਹਲਦੀ ਤੋਂ ਪੀਲਾ ਰੰਗ ਅਤੇ ਹੋਰ ਦੇਗੀ ਮਿਰਚ ਤੋਂ ਲਾਲ ਰੰਗ ਜਾਂ ਇੱਦਾਂ ਆਟੇ ਤੋਂ ਚਿੱਟਾ ਰੰਗ ਇਹ ਇੱਕ ਪਲੇਟ ਦੇ ਵਿੱਚ ਸਜਾ ਕੇ ਆਪਾਂ ਕਿਸੇ ਤੀਲੇ ਨਾਲ ਜਾਂ ਕਿਸੇ ਬਰਸ਼ ਦੇ ਨਾਲ ਆਪਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉਲੀਕਦੇ ਹੁੰਦੇ ਸਨ ਅਤੇ ਬਾਅਦ ਦੇ ਵਿੱਚ ਰਾਤ ਦੇ ਟਾਈਮ ਦਿਵਾਲੀ ਦੇ ਮੌਕੇ 'ਤੇ ਆਪਾਂ ਉਹਦੇ ਅੱਗੇ ਪੂਜਾ ਕਰਦੇ ਹੁੰਦੇ ਸਨ